ਮੋਬਾਇਲ ਅਤੇ ਟੀ ਵੀ ਵਰਗੀਆਂ ਤਕਨੋਲਜੀਆਂ ਦੀ ਬਹੁਤ ਜ਼ਿਆਦਾ ਵਰਤੋਂ ਕਰਨ ਨਾਲ ਬੱਚਿਆਂ ਨੂੰ ਕਾਫੀ ਮਾਨਸਿਕ ਅਤੇ ਸਰੀਰਿਕ ਦੁਰਪ੍ਰਭਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਮਾਨਸਿਕ ਤੌਰ 'ਤੇ ਬੱਚੇ ਜਿਹੜੇ ਆ ਉਹਨਾਂ ਅੱਗੇ ਨਹੀਂ ਜਾਂਦੇ ਜਿੰਨਾ ਕੇ ਉਹ ਜਾ ਸਕਦੇ ਹਨ ਸਰੀਰਕ ਵੀ ਉਹਨਾਂ ਦੀ ਜਿਹੜੀ ਹੈ ਗਰੋਥ ਸਰੀਰਿਕ ਵਾਧਾ ਉਹ ਰੁਕ ਜਾਂਦਾ ਹੈ ਉਹ ਇੰਨੇ ਵੱਧਦੇ ਫੁੱਲਦੇ ਨਹੀਂ ਆਮ ਦੇਖਣ ਵਿੱਚ ਆਇਆ ਹੈ ਕਿ ਜਿਵੇਂ ਪਿੰਡਾਂ ਦੇ ਬੱਚੇ ਜ਼ਿਆਦਾਤਰ ਖੇਡਾਂ ਨੂੰ ਤਰਜੀਹ ਦਿੰਦੇ ਹਨ ਉਹਨਾਂ ਦਾ ਸਰੀਰ ਥੋੜ੍ਹਾ ਖੁੱਲ੍ਹਾ ਹੁੰਦਾ ਹੈ ਗਠਵਾਂ ਹੁੰਦਾ ਹੈ ਅਤੇ ਸ਼ਹਿਰੀਏ ਬੱਚੇ ਜਿਹੜੇ ਆ ਉਹ ਜ਼ਿਆਦਾਤਰ ਕੋਈ ਸਰੀਰਕ ਕੰਮ ਨਹੀਂ ਕਰਦੇ ਨਾ ਉਹ ਕੰਮ ਕਰਦੇ ਆ ਸਾਰਾ ਦਿਨ ਫੋਨ ਲੈ ਕੇ ਬਹਿ ਰਹਿੰਦੇ ਆ ਅਤੇ ਇਸ ਕਰਕੇ ਉਹਨਾਂ ਦਾ ਸਰੀਰਕ ਵੱਧਣਾ ਫੁੱਲਣਾ ਥੋੜ੍ਹਾ ਜਿਹਾ ਦੂਜਿਆਂ ਨਾਲੋਂ ਘੱਟ ਹੁੰਦਾ ਇਸ ਲਈ ਮੋਬਾਇਲ ਦੀ ਜਿਹੜੀ ਆ ਵਰਤੋਂ ਘੱਟ ਕਰਨੀ ਚਾਹੀਦੀ